ਮੈਂ ਨਰਸਰੀ ਤੋਂ ਹੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਿਆ ਹਾਂ ਅਤੇ ਸਕੂਲ ਦੇ ਦੌਰਾਨ ਸਾਰੇ ਵਿਸ਼ੇ ਪੰਜਾਬੀ ਮਾਧਿਅਮ ਦੇ ਵਿੱਚ ਹੀ ਪੜ੍ਹੇ ਹਨ ਗਿਆਰਵੀਂ ਦੇ ਵਿੱਚ ਨੋਨ ਮੈਡੀਕਲ ਦੀ ਪੜ੍ਹਾਈ ਦੇ ਦੋਰਾਨ ਫਿਜਿਕਸ ਕਮਿਸਟਰੀ ਅਤੇ ਮੈਥਮੈਟਿਕਸ ਤਿੰਨੇ ਵਿਸ਼ੇ ਅੰਗਰੇਜ਼ੀ ਦੇ ਵਿੱਚ ਸਨ ਅਤੇ ਉਨਾਂ ਵਿਸ਼ਿਆਂ ਨੂੰ ਪੜ੍ਹਨ ਦੇ ਵਿੱਚ ਬਹੁਤ ਦਿੱਕਤ ਆਈ ਕਿਉਂਕਿ ਦਸਵੀਂ ਤੱਕ ਸਾਰੇ ਵਿਸ਼ੇ ਪੰਜਾਬੀ ਮਾਧਿਅਮ ਦੇ ਵਿੱਚ ਹੀ ਪੜ੍ਹੇ ਸਨ ਉਸ ਤੋਂ ਬਾਅਦ ਜਦੋਂ ਇੰਜੀਨੀਰਿੰਗ ਦੇ ਵਿੱਚ ਅਡਮਿਸ਼ਨ ਹੋਈ ਤਾਂ ਉੱਥੇ ਵੀ ਸਾਰੇ ਵਿਸ਼ੇ ਅੰਗਰੇਜ਼ੀ ਦੇ ਵਿੱਚ ਸਨ ਹਾਲਾਂਕਿ ਲਿਖਣ ਦੇ ਵਿੱਚ ਜਾਂ ਸਮਝਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਖ਼ਾਸ ਦਿੱਕਤ ਨਹੀਂ ਆਈ ਕਿਉਂਕਿ ਡਿਕਸ਼ਨਰੀ ਮੈਂ ਹਮੇਸ਼ਾ ਆਪਣੇ ਕੋਲ ਰੱਖਦਾ ਸੀ ਅਤੇ ਡਿਕਸ਼ਨਰੀ ਤੋਂ ਦੇਖ ਕੇ ਜਿਹੜੇ ਅੰਗਰੇਜ਼ੀ ਦੇ ਔਖੇ ਸ਼ਬਦ ਸਨ ਤਾਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰ ਲੈਂਦਾ ਸੀ ਪਰ ਅੰਗਰੇਜ਼ੀ ਬੋਲਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਸੀ ਜੋ ਕਿ ਇੰਜੀਨੀਅਰਿੰਗ ਖ਼ਤਮ ਹੋਣ ਤੱਕ ਰਹੀ ਅਤੇ ਅੰਗਰੇਜ਼ੀ ਨਾ ਬੋਲ ਸਕਣ ਕਾਰਨ ਹੀ ਕਈ ਇੰਟਰਵਿਊਜ਼ ਦੇ ਵਿੱਚ ਅੱਗੇ ਨਾ ਵੱਧ ਸਕਿਆ ਉਸ ਤੋਂ ਬਾਅਦ ਟੀਚਿੰਗ ਜੋਬ ਦੇ ਵਿੱਚ ਜਦੋਂ ਆਇਆ ਤਾਂ ਇੱਕ ਗੱਲ ਠਾਣ ਲਈ ਕਿ ਹੁਣ ਜੋ ਵੀ ਲੈਕਚਰ ਹੋਏਗਾ ਉਹ ਇੰਗਲਿਸ਼ ਦੇ ਵਿੱਚ ਹੀ ਹੋਏਗਾ ਅਤੇ ਇਸ ਤਰ੍ਹਾਂ ਮੈਂ ਅੰਗਰੇਜ਼ੀ ਨੂੰ ਬੋਲਣ ਦੀ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਹੌਲੀ ਹੌਲੀ ਇਸ ਡਰ ਨੂੰ ਖ਼ਤਮ ਕੀਤਾ ਅਤੇ ਅੱਜ ਮੈਂ ਅੰਗਰੇਜ਼ੀ ਭਾਸ਼ਾ ਨੂੰ ਬਹੁਤ ਚੰਗੀ ਤਰ੍ਹਾਂ ਬੋਲ ਸਕਦਾ ਹਾਂ